ਅਸੀਂ ਆਪਣੇ ਨੇੜਲੇ ਪਿੰਡਾਂ ਵਿੱਚ ਜਾ ਕੇ ਦੇਖਦੇ ਹਾਂ ਜੋ ਯੰਗ ਬੱਚੇ ਕੁੜੀਆਂ ਉਹਨਾਂ ਲਈ ਅਸੀਂ ਕਈ ਜਗ੍ਹਾ ਸੈਂਟਰ ਖੁੱਲ੍ਹੇ ਹੋਏ ਸਿਲਾਈ ਦੇ ਉਹਨਾਂ ਵਿੱਚ ਦੇਖਦੇ ਹਾਂ ਜਾ ਕੇ ਫੇਰ ਬਹੁਤ ਵਧੀਆ ਕੁੜੀਆਂ ਕੱਪੜੇ ਸਿਉਂਦੀਆਂ ਅਤੇ ਫਿਰ ਅਸੀਂ ਜਿਹੜੇ ਬਹੁਤ ਅੱਛੇ ਕੰਮ ਕਰਦੀਆਂ ਜਾਂ ਅੱਛੇ ਸੂਟ ਸਿਉਂਦੀਆਂ ਹੈ ਉਹਨਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹੈ ਜਿਵੇਂ ਉਹਨਾਂ ਨੂੰ ਫੇਰ ਡਿਸਟਰਿਕਟ ਪੱਧਰ 'ਤੇ ਇਨਾਮ ਵੀ ਦਿੱਤੇ ਜਾਂਦੇ ਹੈ ਉਹਨਾਂ ਦੇ ਮੁਕਾਬਲਿਆਂ 'ਚ ਜਿਹੜਾ ਸਭ ਤੋਂ ਵਧੀਆ ਕੰਮ ਕਰਦਾ ਹੈ ਉਹਨਾਂ ਨੂੰ ਬਹੁਤ ਵਧੀਆ ਇਨਾਮ ਦਿੱਤੇ ਜਾਂਦੇ ਹੈ ਹੋਰ ਵੀ ਨਾਲ ਪਾਸ ਦੇ ਪਿੰਡਾਂ ਵਿੱਚ ਹੋਰ ਸੈਂਟਰ ਵੀ ਖੋਲ੍ਹਦੇ ਹਾਂ ਜਾ ਕੇ ਅਸੀਂ ਇੱਕ ਸਾਡੀ ਕਮੇਟੀ ਬਣੀ ਹੋਈ ਹੈ ਜਿਸ ਵਿੱਚ ਅਸੀਂ ਸਾਰੇ ਇਹ ਕੰਮ ਕਰਦੇ ਹਾਂ ਇਹ ਆਪਣਾ ਬੱਚਿਆਂ ਨੂੰ ਇਸ ਅੱਛੇ ਪਾਸੇ ਲਗਾਉਂਦੇ ਹਾਂ ਇਨਾਮ ਵਿੱਚ ਸਿਲਾਈ ਮਸ਼ੀਨਾਂ ਹੋ ਗਈਆਂ ਜਿਵੇਂ ਬੱਚਿਆਂ ਨੂੰ ਪੈਸੇ ਵੀ ਦਿੰਦੇ ਹਾਂ ਗਰੀਬ ਬੱਚੇ ਹੈ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਬੱਚਿਆਂ ਦਾ ਰੁਝਾਨ ਵੀ ਵੱਧਦਾ ਕੰਮ ਸਿੱਖਣ ਲਈ ਅਤੇ ਇਹ ਵਾਲੇ ਉਪਰਾਲੇ ਅਸੀਂ ਕਰਦੇ ਰਹਿੰਦੇ ਹਾਂ